ਹਾਂਜੀ ਟੈਕਨੋਲਜੀ ਨੇ ਨਾ ਟਰਾਂਸਪੋਰਟੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਹੈ ਜਿਵੇਂ ਅਸੀਂ ਟਿਕਟਾਂ ਬੁਕਿੰਗ ਕਰਦੇ ਹਾਂ ਤਾਂ ਹੋਟਲ ਬੁੱਕ ਕਰਨਾ ਹੈ ਨਾ ਅਤੇ ਜਾਂ ਸੀਮੇ ਟਰੇਨ ਦੇ ਜਿਹੜੇ ਵੀ ਟ੍ਰੇਨ ਦੀਆਂ ਵੀ ਟਿਕਟਾਂ ਦੀ ਬੁਕਿੰਗ ਕਰਦੇ ਹੈਗੇ ਉਹ ਸਾਰਾ ਚ ਚੀਜ਼ਾਂ ਨਾ ਜਿਹਨਾਂ ਵੀ ਇਹਨੂੰ ਬਹੁਤ ਜ਼ਿਆਦਾ ਟੈਕਨਾਲੋਜੀ ਨੇ ਸਾਨੂੰ ਸੌਖਾ ਬਣਾਤਾ ਵੀ ਅੱਗੇ ਐਂ ਹੁੰਦਾ ਸੀਗਾ ਜਿਵੇਂ ਹੁਣ ਅਸੀਂ ਹਰਮਿੰਦਰ ਸਾਹਿਬ ਜਾਂਦੇ ਹੈਗੇ ਜਾ ਕੇ ਰੂਮ ਵਗੈਰਾ ਲੈਣਾ ਪੈਂਦਾ ਹੈ ਨਾ ਕਦੇ ਮਿਲਦਾ ਕਦੇ ਨਾ ਮਿਲਦਾ ਹੁਣ ਜਿਹੜਾ ਕਿ ਅਸੀਂ ਨਾ ਆਨਲਾਈਨ ਹੀ ਸਾਰਾਗੜੀ ਜਾਂ ਜਿਹੜੀ ਸਰਾਂ ਬਣੀ ਵੀ ਸਾਰਾਗੜੀ ਉਹਦੇ ਵਿੱਚ ਪਹਿਲਾਂ ਹੀ ਅਸੀਂ ਮਹੀਨਾ ਪਹਿਲਾਂ ਹੀ ਆਪਦਾ ਬੁਕਿੰਗ ਕਰ ਲੈਂਦੇ ਹਾਂ ਕਮਰਿਆਂ ਦੀ ਤਾਂ ਉਹ ਕਿੰਨੀ ਸੌਖ ਹੋਊਗੀ ਨਾ ਆਪਾਂ ਨੂੰ ਅਤੇ ਜਿਵੇਂ ਕਿ ਇੱਧਰ ਅਸੀਂ ਇੱਧਰ ਗਏ ਸੀ ਆਪਣਾ ਹਜੂਰ ਸਾਹਿਬ ਜਾਂਦੇ ਹਾਂ ਉਹ ਟਿਕਟਾਂ ਅੱਗੇ ਸਟੇਸ਼ਨ 'ਤੇ ਜਾਣਾ ਪੈਂਦਾ ਫਾਰਮ ਭਰਨੇ ਪੈਂਦੇ ਨਹੀਂ ਹੁਣ ਆਨਲਾਈਨ ਸਾਰੀਆਂ ਅਸੀਂ ਟਿਕਟਾਂ ਦੇ ਅਧਾਰ ਕਾਰਡ ਦੇ ਨਾਲ ਉਹ ਕਰ ਲਿਆ ਆਧਾਰ ਕਾਰਡ ਕੋਲ ਰੱਖਣੇ ਮੈਂ ਸਾਰੀਆਂ ਟਿਕਟਾਂ ਦੀ ਬੁਕਿੰਗ ਕਰਤੀ ਅਤੇ ਉਹ ਸਾਰੀਆਂ ਆਉਣ ਜਾਣ ਦੀਆਂ ਮੈਂ ਟਿਕ ਟਿਕਟਾਂ ਦੀ ਬੁਕਿੰਗ ਕਰ ਲਈ ਫਿਰ ਉੱਥੇ ਸਰਾਂ ਦੇ ਵਿੱਚ ਵੀ ਮੈਂ ਸਾਰੀਆਂ ਆਨਲਾਈਨ ਬੁਕਿੰਗ ਕਰ ਲਈ ਤਾਂ ਜਿਹੜਾ ਕਿ ਇਹ ਸਾਰੀਆਂ ਚੀਜ਼ਾਂ ਦੀ ਸੌਖ ਕਰ ਤੀ ਸਾਨੂੰ ਟੈਕਨੋਲਜੀ ਦੇ ਆਉਣ ਦੇ ਨਾਲ ਵੀ ਬਹੁਤ ਸੌਖਾ ਲੱਗਦਾ ਗਾ ਹੈ ਨਾ ਇਹ ਸਾਰੀਆਂ ਚੀਜ਼ਾਂ ਬਹੁਤ ਵਧੀਆ ਹੈਗੀਆਂ